ਸਾਡੇ ਕੋਲ ਆਪਣੀ ਵਿਹੜੇ ਵਿੱਚ ਪੰਛੀਆਂ ਨੂੰ ਆਕਰਸ਼ਿਤ ਕਰਨ ਲਈ ਬਹੁਤ ਸਾਰੇ ਸੁਝਾਅ ਹਨ ਜਿਵੇਂ ਜਿਵੇਂ ਕਿ ਅੱਜ ਕੱਲ੍ਹ ਰੈਡੀਮੇਟ ਆਲਣੇ ਆਉਂਦੇ ਹੈ ਉਹਨਾਂ ਨੂੰ ਘਰਾਂ 'ਚ ਘਰਾਂ 'ਚ ਲੋਕੀਂ ਟੰਗਦੇ ਆ ਤਾਂ ਕਿ ਜੋ ਜਿਹੜੀਆਂ ਚਿੜੀਆਂ ਏ ਇੱਥੇ ਆ ਕੇ ਰਹਿਣ ਤਾਂ ਅਤੇ ਬਹੁਤ ਸਾਰੇ ਅਲੱਗ ਅਲੱਗ ਤਰ੍ਹਾਂ ਦੇ ਲੋਕੀਂ ਆਪਣੇ ਵਿਹੜੇ ਵਿੱਚ ਇਹਨਾਂ ਨੂੰ ਪਾਣੀ ਰੱਖਦੇ ਹੈ ਅਨਾਜ ਦਿੰਦੇ ਹੈ ਅਤੇ ਅਲੱਗ ਅਲੱਗ ਤਰ੍ਹਾਂ ਦੇ ਤਰ੍ਹਾਂ ਦੇ ਸੁਝਾਅ ਬਹੁਤ ਸਾਰੇ ਲੋਕਾਂ ਨੇ ਕੁਝ ਪੰਛੀ ਆਪਣੇ ਘਰ ਵੀ ਰੱਖੇ ਹੈ ਅਤੇ ਜਿ ਜਿਨ੍ਹਾਂ ਘਰਾਂ ਵਿੱਚ ਦਰੱਖਤ ਹੁੰਦੇ ਆ ਉਹਨਾਂ ਘਰਾਂ ਵਿੱਚ ਤਾਂ ਪੰਛੀ ਖੁਦ ਹੀ ਆ ਕੇ ਆਪਣਾ ਆਲਣਾ ਬਣਾਉਂਦੇ ਆ ਅਤੇ ਰਹਿੰਦੇ ਹੈ ਜਦੋਂ ਉਹ ਚੀਂ ਚੀਂ ਕਰਦੇ ਬਹੁਤ ਅਲੱਗ ਹੀ ਅਲੱਗ ਖੁਸ਼ੀ ਦਿੰਦੇ ਹਾਂ ਅੰਦਰੋਂ ਆਨੰਦ ਮਹਿਸੂਸ ਹੁੰਦਾ ਪੰਛੀਆਂ ਦੀ ਚੀਂ ਚੀਂ ਸੁਣ ਕੇ ਅਤੇ ਅਸੀਂ ਅਸੀਂ ਅਤੇ ਅਸੀਂ ਆਪਣੇ ਘਰ ਵਿੱਚ ਅਲੱਗ ਅਲੱਗ ਅਲੱਗ ਤਰ੍ਹਾਂ ਦੇ ਆਲਣੇ ਟੰਗੇ ਹੋਏ ਆ ਤਾਂ ਕਿ ਜੋ ਇਹਨਾਂ ਵਿੱਚ ਪੰਛੀ ਠੰਡ ਦੇ ਮੌਸਮ 'ਚ ਇਹਨਾਂ 'ਚ ਪੰਛੀ ਆ ਕੇ ਰਹਿ ਸਕਣ ਅਤੇ ਅਸੀਂ ਆਪਣੇ ਅਤੇ ਅਸੀਂ ਆਪਣੇ ਘਰ ਵਿੱਚ ਘਰ ਦੇ ਵਿਹੜੇ ਵਿੱਚ ਪੰਛੀਆਂ ਲਈ ਅਨਾਜ ਅਤੇ ਪਾਣੀ ਦਾ ਪੂਰਾ ਪ੍ਰਬੰਧ ਕਰਦੇ ਹਾਂ ਅਤੇ ਜਦੋਂ ਪੰਛੀ ਆ ਕੇ ਇੱਥੇ ਉੜ ਕੇ ਇੱਥੇ ਆ ਕੇ ਜਦੋਂ ਪਾਣੀ ਪੀਂਦੇ ਹਨ ਤਾਂ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਅਤੇ ਅਨਾਜ ਖਾਂਦੇ ਹਨ ਅਤੇ ਚੀਂ ਚੀਂ ਕਰਦੇ ਚੀਂ ਚੀਂ ਕਰਦੇ ਵਿਹੜੇ ਵਿੱਚ ਘੁੰਮਦੇ ਤਾਂ ਬਹੁਤ ਖੁਸ਼ੀ